ਗਿਆਰਾਂ ਜੀਰੋ ਦੋ ਦੋ ਹਜ਼ਾਰ ਤਿੰਨ ਪੰਦਰਾਂ ਜੀਰੋ ਪੰਜ ਦੋ ਹਜ਼ਾਰ ਇੱਕ ਸੋਲਾਂ ਜੀਰੋ ਅੱਠ ਦੋ ਹਜ਼ਾਰ ਪੰਜ ਤੀਹ ਜੀਰੋ ਇੱਕ ਦੋ ਹਜ਼ਾਰ ਦੋ ਪੰਦਰਾਂ ਜੀਰੋ ਤਿੰਨ ਦੋ ਹਜ਼ਾਰ ਤਿੰਨ